ਜਿਹੜਾ ਪੰਜਾਬੀ ਸੱਭਿਆਚਾਰ ਆ ਉਹ ਬਹੁਤ ਅਮੀਰ ਸੱਭਿਆਚਾਰ ਹੈ ਔਰ ਜਿਹੜੇ ਅੱਜ ਕੱਲ੍ਹ ਦੀ ਨੌਜਵਾਨ ਪੀੜੀ ਇਹਨਾਂ ਸੱਭਿਆਚਾਰਕ ਦੀ ਰੀਤੀ ਰਿਵਾਜਾਂ ਦੀ ਪਾਲਣਾ ਨਹੀਂ ਕਰਦੀ ਕਿਸੇ ਨੂੰ ਨਹੀਂ ਪਤਾ ਸਾਡੀਆਂ ਕਦਰਾਂ ਕੀਮਤਾਂ ਕੀ ਹੈ ਕਿਸੇ ਨੂੰ ਨਹੀਂ ਪਤਾ ਸਾਡੇ ਰੀਤੀ ਰਿਵਾਜ ਕੀ ਹੈ ਸਾਰੇ ਵਿਦੇਸ਼ੀ ਸੱਭਿਆਚਾਰ ਨੂੰ ਅਪਣਾਉਣ 'ਚ ਲੱਗੇ ਹੋਏ ਨੇ ਕਿਸੇ ਨੂੰ ਪਤਾ ਜਾਗੋ ਭੰਗੜਾ ਇਹਦੀ ਕਿਆ ਮਹੱਤਤਾ ਕਿਸੇ ਨੂੰ ਪਤਾ ਗਿੱਧੇ ਦੀ ਕਿਆ ਮਹੱਤਤਾ ਹੈ ਅਸੀਂ ਬਸ ਜਦ ਵਿਆਹਾਂ 'ਚ ਵੀ ਗੀਤ ਲਾ ਕੇ ਵਿਦੇਸ਼ੀ ਗਾਣਿਆਂ 'ਤੇ ਨੱਚੀ ਟੱਪੀ ਜਾਂਦੇ ਹਾਂ ਕੋਈ ਰੀਤੀ ਰਿਵਾਜਾਂ ਦਾ ਨਹੀਂ ਪਤਾ ਕੋਈ ਕਦਰਾਂ ਕੀਮਤਾਂ ਨਹੀਂ ਪਤਾ ਇਸ ਕਰਕੇ ਜਿਹੜਾ ਸਾਡਾ ਸੱਭਿਆਚਾਰ ਹੈ ਉਹਦੀਆਂ ਕਦਰਾਂ ਕੀਮਤਾਂ ਹੈ ਉਹਦੇ ਰੀਤੀ ਰਿਵਾਜ ਹੈ ਉਹ ਢਿੱਲੇ ਪੈ ਰਹੇ ਨੇ ਇਹਨਾਂ ਨੂੰ ਨੌਜਵਾਨਾਂ ਨੂੰ ਦੱਸਣਾ ਚਾਹੀਦਾ ਸੈਮੀਨਾਰ ਲਾਉਣੇ ਚਾਹੀਦੇ ਉਹਨਾਂ ਦੀਆਂ ਕ ਪੜ੍ਹਾਈਆਂ ਚੀਜ਼ਾਂ ਦਾ ਪਾਠ ਹੋਣਾ ਚਾਹੀਦਾ ਤਾਂ ਕਿ ਉਹ ਕਦਰਾਂ ਕੀਮਤਾਂ ਸਿੱਖ ਸਕਣ